ਕਿਹਾ ਜਾਂਦਾ ਹੈ ਕਿ ਕ ਕਰੋਗੇ ਯੋਗ ਰਹੋਗੇ ਨਿਰੋਗ ਯੋਗਾ ਇੱਕ ਬਹੁਤ ਹੀ ਵਧੀਆ ਐਕਸਰਸਾਈਜ਼ ਹੈ ਜੇ ਤੁਸੀਂ ਰੋਜ਼ ਯੋਗਾ ਕਰਦੇ ਹੋ ਤਾਂ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰਹਿੰਦੇ ਹੋ ਯੋਗਾ ਦੇ ਵਿੱਚ ਬਹੁਤ ਹੀ ਅਲੱਗ ਅਲੱਗ ਤਰ੍ਹਾਂ ਦੀਆਂ ਸਟ੍ਰੈਚਿਸ ਆ ਜਾਂਦੀਆਂ ਹਨ ਅ ਜਿਸ ਦੇ ਨਾਲ ਸਾਡੇ ਸਰੀਰ ਦੇ ਅੰਗਾਂ ਦੇ ਵਿੱਚ ਲਚਕ ਆਉਂਦੀ ਹੈ ਅਤੇ ਸਾਡੀ ਬੋਨ ਸਟਰੈਂਥ ਵੀ ਵੱਧਦੀ ਹੈ ਯੋਗਾ ਹਮੇਸ਼ਾ ਕਿਹਾ ਜਾਂਦਾ ਹੈ ਕਿ ਖਾਲੀ ਪੇਟ ਕਰਨੀ ਚਾਹੀਦੀ ਹੈ ਯੋਗਾ ਕਰਨ ਤੋਂ ਪਹਿਲਾਂ ਤੁਸੀਂ ਪਾਣੀ ਪੀ ਸਕਦੇ ਹੋ ਅਤੇ ਯੋਗਾ ਕਰਨ ਦੇ ਦੌਰਾਨ ਤੁਸੀਂ ਖਾਲੀ ਪੇਟ ਹੀ ਰਹਿਣਾ ਹੁੰਦਾ ਹੈ ਇਹਦੇ ਵਿੱਚ ਤੁਸੀਂ ਪ੍ਰਣਯਾਮ ਕਰ ਸਕਦੇ ਹੋ ਪ੍ਰਣਯਾਮ ਮਤਲਬ ਸਾਹ ਵਾਲੀ ਐਕਸਰਸਾਈਜ਼ਿਜ਼ ਕਰ ਸਕਦੇ ਹੋ ਜਿਵੇਂ ਕਿ ਸਾਹ ਨੂੰ ਅੰਦਰ ਬਾਹਰ ਕਰਨਾ ਨੱਕ ਦੇ ਰਾਹੀਂ ਸਾਹ ਲੈ ਕੇ ਮੂੰਹ ਵਿੱਚੋਂ ਕੱਢਣਾ ਜਾਂ ਮੂੰਹ ਦੇ ਵਿੱਚੋਂ ਲੈ ਕੇ ਨੱਕ ਰਾਹੀਂ ਕੱਢਣਾ ਸ ਯੋਗਾ ਦੇ ਵਿੱਚ ਸਭ ਤੋਂ ਵਧੀਆ ਸੂਰਯ ਨਮਸਕਾਰ ਹੁੰਦਾ ਹੈ ਜੋ ਕਿ ਆਪਣੇ ਆਪ ਵਿੱਚ ਹੀ ਇੱਕ ਕੰਪਲੀਟ ਯੋਗਾ ਹੁੰਦਾ ਹੈ ਇਸ ਦੇ ਵਿੱਚ ਟੋਟਲ ਬਾਰਾਂ ਐਕਸਰਸਾਈਜ਼ਾਂ ਹੁੰਦੀਆਂ ਹਨ ਅੱਠ ਸ਼ੁਰੂ ਵਾਲੀਆਂ ਅਤੇ ਚਾਰ ਵਾਪਸੀ ਵਾਲੀਆਂ ਹੁੰਦੀਆਂ ਨੇ ਅਤੇ ਜੇ ਆਪਾਂ ਬਾਰਾਂ ਸੂਰਯ ਨਮਸ਼ ਕਰ ਕਰ ਲੈਂਦੇ ਹਾਂ ਤਾਂ ਸਾਡੀ ਇੱਕ ਕੰਪਲੀਟ ਐਕਸਰਸਾਈਜ਼ ਪੈਕੇਜ ਕੰਪਲੀਟ ਹੋ ਜਾਂਦਾ ਹੈ ਯੋਗਾ ਨੇ ਮੈਨੂੰ ਬਹੁਤ ਹੀ ਬਦਲਿਆ ਹੈ ਯੋਗਾ ਦੇ ਨਾਲ ਮੇਰੇ ਚਿਹਰੇ ਦੇ ਉੱਤੇ ਰੌਣਕ ਆਈ ਹੈ ਮੈਂ ਆਪਣੇ ਆਪ ਨੂੰ ਬਹੁਤ ਹੀ ਪੋਜ਼ੀਟਿਵ ਮਹਿਸੂਸ ਕਰਦੀ ਹਾਂ ਪਹਿਲਾਂ ਮੈਂ ਬਹੁਤ ਹੀ ਉਦਾਸ ਅਤੇ ਆਲਸੀ ਰਹਿੰਦੀ ਸੀ ਪਰ ਜਿਸ ਦਿਨ ਤੋਂ ਮੈਂ ਯੋਗਾ ਸ਼ੁਰੂ ਕੀਤਾ ਹੈ ਯੋਗਾ ਕਰਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਏਨੇਜੈਟਿਕ ਮਹਿਸੂਸ ਕਰਦੀ ਹਾਂ ਅਤੇ ਮੈਂ ਖੁਸ਼ ਵੀ ਰਹਿੰਦੀ ਹਾਂ ਜਿਸ ਦਿਨ ਮੈਂ ਯੋਗਾ ਨਹੀਂ ਕਰਦੀ ਮੈਨੂੰ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਮੇਰਾ ਅੱਜ ਪੂਰੇ ਦਿਨ ਦੇ ਵਿੱਚ ਕੁਛ ਨਾ ਕੁਛ ਕੋਈ ਕਮੀ ਰਹੀ ਹੈ ਜੋ ਮੈਨੇ ਕੀਤੀ ਨਹੀਂ ਹੈ ਜਿਸ ਦਿਨ ਮੇਰੇ ਤੋਂ ਯੋਗਾ ਨਹੀਂ ਹੁੰਦੀ ਉਸ ਦਿਨ ਮੈਂ ਸੈਰ 'ਤੇ ਚਲੀ ਜਾਂਦੀ ਹਾਂ ਅਤੇ ਪੰਤਾਲੀ ਮਿੰਟ ਦੀ ਸੈਰ ਕਰਦੀ ਹਾਂ